ਭਾਰ ਘਟਾਉਣ ਵਾਸਤੇ ਵੈਸੇ ਤਾਂ ਜ਼ਿਆਦਾਤਰ ਪਿੰਡਾਂ ਵਿੱਚ ਜ਼ਿਆਦਾ ਭਾਰ ਦੀ ਕੋਈ ਪ੍ਰੋਬਲਮ ਨਹੀਂ ਪਾਈ ਜਾਂਦੀ ਹੈ ਪਰ ਫਿਰ ਵੀ ਜੇ ਕੋਈ ਕਿਸੇ ਦਾ ਭਾਰ ਵੱਧਦਾ ਹੈ ਤਾਂ ਉਸਨੂੰ ਵਰਜਿਸ਼ ਕਰਨੀ ਚਾਹੀਦੀ ਹੈ ਦੌੜ ਲਗਾਉਣ ਨਾਲ ਵੀ ਭਾਰ ਘੱਟਦਾ ਹੈ ਜਿਵੇਂ ਤੈਰਨ ਨਾਲ ਵੀ ਭਾਰ ਘੱਟਦਾ ਹੈ ਹੋਰ ਜਿੰਨੀ ਵੀ ਵਰਜਿਸ਼ ਕੀਤੀ ਜਾਵੇ ਅਤੇ ਉਹ ਭਾਰੇ ਸਰੀਰ ਨੂੰ ਪਤਲਾ ਕਰਨ ਵਿੱਚ ਬਹੁਤ ਹੀ ਫਾਇਦੇਮੰਦ ਹੋਵੇਗੀ ਜੇ ਗੱਲ ਕਰੀਏ ਫੂਡ ਦੀ ਤਾਂ ਤਲਿਆ ਬਿਲਕੁਲ ਨਹੀਂ ਖਾਣਾ ਚਾਹੀਦਾ ਭਾਰੇ ਬੰਦੇ ਨੂੰ ਉਸਨੂੰ ਗ੍ਰੀਨ ਟੀ ਸਵੇਰ ਵੇਲੇ ਜਾਂ ਨਿੰਬੂ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਨਮਕ ਪਾ ਕੇ ਪੀਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਦੋ ਦੋ ਤਿੰਨ ਟਾਈਮ ਪੀਣ ਨਾਲ ਉਸਦਾ ਭਾਰ ਵੀ ਘਟੇਗਾ ਦੂਜੀ ਵਰਜਿਸ਼ ਵੀ ਜ਼ਰੂਰੀ ਹੈ ਸਾਡੇ ਹੋਰ ਇੱਥੇ ਕੋਈ ਵੀ ਭਾਰ ਦੀ ਪ੍ਰੋਬਲਮ ਹੁੰਦੀ ਹੈ ਤਾਂ ਇਹੋ ਕੁਛ ਹੀ ਜ਼ਿਆਦਾਤਰ ਕੀਤਾ ਜਾਂਦਾ ਹੈ